ਅਸੀਂ ਚਾਰ ਭੈਣ ਭਰਾ ਹਨ ਜਦ ਕਿ ਮੇਰੇ ਤਿੰਨ ਬ੍ਰਦਰਸ ਅਤੇ ਇੱਕ ਭੈਣ ਮੈਂ ਹਾਂ ਅਤੇ ਸਾਡੇ ਚਾਰਾਂ ਦਾ ਹੀ ਪ੍ਰੋਫੈਸ਼ਨ ਅਲੱਗ ਅਲੱਗ ਆ ਕੋਈ ਸਪੋਰਟਸ 'ਚ ਆ ਅਤੇ ਕੋਈ ਟੈਕਨੋਲੋਜੀ ਵੱਲ ਨੂੰ ਆ ਅਤੇ ਕੋਈ ਆਪਣੀ ਸਟੱਡੀ ਬੇਸ 'ਤੇ ਆ ਅਤੇ ਕੋਈ ਬਾਹਰ ਜਾਣ ਨੂੰ ਫਿਰਦਾ ਆ ਬਟ ਸਾਡੇ ਤਿੰਨਾਂ 'ਚ ਇੱਕ ਚੀਜ਼ ਸਿਮੀਲਰ ਆ ਸਾਨੂੰ ਜਲਦੀ ਜਲਦੀ ਗੁੱਸਾ ਨਹੀਂ ਆਉਂਦਾ ਤਿੰਨਾਂ ਨੂੰ ਅਤੇ ਅਸੀਂ ਤਿੰਨ ਚਾਰੋਂ ਹੀ ਬੜੇ ਰਲ ਮਿਲ ਕੇ ਰਹਿੰਦੇ ਹਾਂ ਅਤੇ ਬਟ ਇੱਕ ਬ੍ਰਦਰ ਆ ਜਿਹੜਾ ਮੇਰਾ ਉਹ ਬਹੁਤ ਗੁੱਸੇ ਵਾਲ਼ਾ ਆ ਜਿਹਨੂੰ ਛੋਟੀ ਛੋਟੀ ਗੱਲ 'ਤੇ ਵੀ ਗੁੱਸਾ ਚੜ੍ਹ ਜਾਂਦਾ ਆ ਬਟ ਸਾਡੇ ਪੇਰੈਂਟਸ ਨੇ ਸਾਨੂੰ ਇੱਕ ਹੀ ਚੀਜ਼ ਸਿਖਾਈ ਆ ਬੀਨ ਯੂਨਿਟੀ ਤਾਂ ਕਿ ਅਸੀਂ ਅੱਗੇ ਜਾ ਕੇ ਵੀ ਚਾਰ ਬੰਦੇ ਨੂੰ ਇਹ ਸ਼ਿਕਸ਼ਾ ਦੇ ਸਕੀਏ ਕਿ ਕਦੇ ਵੀ ਨਹੀਂ ਹੁੰਦਾ ਵੀ ਭੈਣ ਭਾਈਆਂ 'ਚ ਕਦੇ ਵੀ ਫਿੱਕ ਪੈ ਸਕੇ ਹੈ ਨਾ ਜੇ ਅਗਰ ਚਾਰ ਰਲ ਕੇ ਰਹੋਂਗੇ ਤਾਂ ਇੱਕ ਤੁਸੀਂ ਸੁਣਿਆ ਵੀ ਹੋਣਾ ਕਿ ਏਕਤਾ ਨੂੰ ਕੋਈ ਤੋੜ ਨਹੀਂ ਸਕਦਾ ਜਦੋਂ ਚਾਰ ਬ੍ਰਦਰਸ ਇਕੱਠੇ ਹੋਣ ਹੈ ਨਾ ਉਦੋਂ ਉਹਨਾਂ ਨੂੰ ਕੋਈ ਵੀ ਨਹੀਂ ਤੋੜ ਸਕਦਾ ਬਟ ਜੇ ਇਕੱਲੇ ਇਕੱਲੇ ਕਰ ਕਰਕੇ ਤੋੜਾਂਗੇ ਤਾਂ ਹਰ ਇੱਕ ਟੁੱਟ ਹੀ ਜਾਂਦਾ ਹੈ ਮੋਸਟਲੀ ਸੋ ਬੈਸਟ ਆ ਰਲ ਮਿਲ ਕੇ ਰਹਿਣਾ ਚਾਹੀਦਾ ਆਪਾਂ ਨੂੰ ਜਿੰਨੀ ਵੀ ਆਪਾਂ ਬ੍ਰਦਰ ਸਿਸਟਰਸ ਹੁੰਦੇ ਆ ਹਰ ਇੱਕ ਦੀ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਚਾਹੇ ਦੁੱਖ ਆ ਚਾਹੇ ਸੁੱਖ ਆ ਸੋ ਇਹੀ ਮੇਰਾ ਸੁਝਾਅ ਆ